ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜਦੋਂ ਸਟਡੀ ਦੇ ਨਾਲ ਜਦੋਂ ਵੀ ਟਾਈਮ ਲੱਗਦਾ ਫਿਰ ਵਿਹਲੇ ਹੁੰਦੇ ਹਾਂ ਸਟਡੀ ਕੰਪਲੀਟ ਕਰਕੇ ਬੁੱਕਸ ਪੜ੍ਹਨ ਲੱਗ ਜਾਂਦੇ ਹਾਂ ਜਾਂ ਲਾਇਬਰੇਰੀ ਚਲੇ ਜਾ ਮੈਨੂੰ ਸਭ ਤੋਂ ਜ਼ਿਆਦਾ ਸੂਫੀ ਕਾਫੀ ਪਸੰਦ ਆ ਅਤੇ ਹੋਰ ਧਾਰਮਿਕ ਬੁਕਸਾਂ ਅਤੇ ਹੋਰ ਕਹਾਣੀਆਂ ਵੀ ਬਹੁਤ ਵਧੀਆ ਪਸੰਦ ਆ ਕਿਉਂਕਿ ਪੰਜਾਬੀ ਆਪਣੀ ਮਾਤ ਭਾਸ਼ਾ ਪੰਜਾਬੀ 'ਚ ਪਸੰਦ ਆ ਮੈਨੂੰ ਇਹਦੇ ਵਿੱਚ ਸੁਰਜੀਤ ਪਾਤਰ ਹੋ ਗਿਆ ਸ਼ਿਵ ਕੁਮਾਰ ਬਟਾਲਵੀ ਹੋ ਗਿਆ ਅੰਮ੍ਰਿਤਾ ਪ੍ਰੀਤਮ ਵਾਰਿਸ ਸ਼ਾਹ ਹੋ ਗਿਆ ਬੁੱਲੇ ਸ਼ਾਹ ਹੋ ਗਏ ਇਹਦੇ ਜਿਹੜੇ ਲਿਖੇ ਕਾਫੀ ਨਿਬੰਧ ਲਿਖੇ ਹੋਏ ਆ ਇਹ ਵੀ ਵਧੀਆ ਲੱਗਦੇ ਆ ਭਗਤੀ ਲਹਿਰ ਨਾਲ ਹੈਗੇ ਆ ਦੀਵਾਨ ਸਿੰਘ ਕਾਲੇ ਪਾਣੀ ਇਹਦੀ ਵੀ ਵਧੀਆ ਲੱਗਦੀ ਆ ਲਿਖਿਆ ਵਾ ਪਰ ਸਭ ਤੋਂ ਜ਼ਿਆਦਾ ਅੰਮ੍ਰਿਤਾ ਪ੍ਰੀਤਮ ਲੱਗਦੀ ਕਿਉਂਕਿ ਉਹਨਾਂ ਨੇ ਇਸਤਰੀ ਦੇ ਜਿਹੜੀ ਨਾਰੀ ਦੇ ਰੂਪ ਵਿੱਚ ਵਧੀਆ ਉਹਨਾਂ ਨੂੰ ਪ੍ਰਭਾਵਿਤ ਕੀਤਾ ਅਤੇ ਨਵੇਂ ਨਾਰੀ ਨੂੰ ਆਉਣ ਵਾਲੇ ਸਮਾਜ ਵਿੱਚ ਵਧੀਆ ਰੂਪ ਦਿੱਤਾ ਜਿਸ ਨਾਲ ਉਹਦੀ ਔਰਤਾਂ ਦੇ ਵਿੱਚ ਜਿਹੜੀ ਉਹ ਉਹਨਾਂ ਦੀਆਂ ਭਾਵਨਾਵਾਂ 'ਤੇ ਪੇਸ਼ ਕੀਤਾ ਭਾਵਨਾਵਾਂ ਨੂੰ ਪੇਸ਼ ਕੀਤਾ ਬਈ ਕਿਉਂਕਿ ਪਹਿਲਾਂ ਪਹਿਲਾਂ ਦੇ ਸਮੇਂ ਵਿੱਚ ਭਾਵੇਂ ਹੁਣ ਆਪਾਂ ਦੇਖਦੇ ਸੀਗੇ ਵੀ ਮਰਦ ਜਿਹੜੇ ਔਰਤਾਂ ਨੂੰ ਹੁਣ ਪੈਰਾਂ ਦੀ ਜੁੱਤੀ ਦੇ ਸਮਾਨ ਸਮਝਦੇ ਸਨ ਅਤੇ ਉਹਦੇ ਵਿੱਚ ਉਹਨੇ ਅੰਮ੍ਰਿਤਾ ਪ੍ਰੀਤਮ ਨੇ ਖੁੱਲ੍ਹ ਕੇ ਦੱਸਿਆ ਵੀ ਇਹ ਇਸਤਰੀ ਵੀ ਕਿਸ ਤਰ੍ਹਾਂ ਉਹਦੀ ਦੁਰਦਸ਼ਾ ਹੁੰਦੀ ਸੀਗੀ ਪਰ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਬੀ ਦੱਸਿਆ ਵੀ ਕਿਵੇਂ ਉਹਨਾਂ ਨੂੰ ਕੋਈ ਮਰਦਾਂ ਦੇ ਬਰਾਬਰ ਕਿਵੇਂ ਲੜ ਸਕਦੀਆਂ ਕਿਵੇਂ ਉਹ ਕਰ ਸਕਦੇ ਸਮਾਜ ਵਿੱਚ ਵਿਚਰ ਸਕਦੇ ਹਾਂ ਹਾਂਜੀ ਹਾਂਜੀ ਬੁੱਲੇ ਸ਼ਾਹ ਦਾ ਵਧੀਆ ਕਿਉਂਕਿ ਬੁੱਲੇ ਸ਼ਾਹ ਨੇ ਬੁੱਲੇ ਸ਼ਾਹ ਨੇ ਇੱਕ ਬਈ ਆਪਦੇ ਪਰਮਾਤਮਾ ਦੇ ਨਾਲ ਜੋੜਿਆ ਆਤਮਾ ਨੂੰ ਕਿਉਂਕਿ ਬਹੁਤ ਵਧੀਆ ਮਿਲ ਜਾਂਦੇ ਆ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਓ ਸੁਰਜੀਤ ਪਾਤਰ ਦੀਆਂ ਇਹ ਨਾ ਕਹਾਣੀਆਂ ਵੀ ਹਨ ਤੁਸੀਂ ਪੜ੍ਹੋ ਜੇ ਉਹਦੇ ਵਿੱਚ ਆਪਣੀ ਜਿਹੜੀ ਆਮ ਜੀਵਨ ਦੇ ਵਿੱਚ ਇਹਦੇ ਵਿੱਚ ਰਹੀਆਂ ਗੱਲਾਂ ਉਹਦੇ ਬਾਰੇ ਪਹਿਲਾਂ ਹੀ ਦੱਸ ਚੁੱਕੇ ਆ

ਹਾਂਜੀ ਹਾਂਜੀ ਪਰ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਪੜ੍ਹਦੀ ਨਹੀਂ ਟਾਵਾਂ ਟਾਵਾਂ ਬੱਚਾ ਹੀ ਪੜ੍ਹਦਾ ਵੀ ਜ਼ਿਆਦਾਤਰ ਮੋਬਾਇਲਾਂ ਦੇ ਵਿੱਚ ਪਏ ਰਹਿੰਦੇ ਆ ਕਿਉਂਕਿ ਕਿਤਾਬਾਂ ਬਣਾਈਆਂ ਹੀ ਪੜ੍ਹਨ ਵਾਸਤੇ ਜੇ ਆਪਾਂ ਪੜ੍ਹਾਂਗੇ ਆਪਾਂ ਨੂੰ ਕੋਈ ਸਿੱਖਣ ਨੂੰ ਹੀ ਮਿਲੇਗਾ ਹਾਂਜੀ ਮੈਂ ਤਾਂ ਬ ਜਦੋਂ ਵੀ ਕਿਸੇ ਮੇਲਾ ਲੱਗਦਾ ਜਿਵੇਂ ਹੁਣ ਉੱਥੇ ਫਰੀਦਕੋਟ ਲੱਗਦਾ ਪੁਸਤਕ ਦਾ ਮੇਲਾ ਬਾਬਾ ਫਰੀਦ ਉੱਥੇ ਹੁਣ ਉੱਥੇ ਲੱਗਦਾ ਖਾਸ ਸਪੈਸ਼ਲ ਪੁਸਤਕਾਂ ਦਾ ਹੀ ਲੱਗਦਾ ਭਲੇ ਆਉਂਦਾ ਹੁੰਦਾ ਮਿਲ ਜਾਂਦਾ ਹੁੰਦਾ

ਹਾਂਜੀ ਹਾਂਜੀ ਜ਼ਰੂਰ ਮੈਂ ਮੇਰੇ ਕੋਲ ਬੁੱਕਸ ਪਾਈਆਂ ਬਹੁਤ ਆ ਵਧੀਆ ਲੇਖਕਾਂ ਦੀਆਂ ਮੈਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਉਹਨਾਂ ਲੋਕਾਂ ਨੂੰ ਠੀਕ ਹੈ ਜੀ ਧੰਨਵਾਦ